ਮੌਜੂਦਾ ਰੁਝਾਨਾਂ ਨਾਲ ਜੁੜੇ ਰਹਿਣ ਲਈ ਅਸੀਂ ਅਜਾਇਬ ਘਰਾਂ ਦਾ ਦੌਰਾ ਕਰਦੇ ਹਾਂ ਅਸੀਂ ਸ਼੍ਰੀ ਅੰਮ੍ਰਿਤਸਰ ਵੀ ਜਾਂਦੇ ਹਾਂ ਉੱਥੇ ਵੀ ਮਾਹੌਲ ਬਿਲਕੁਲ ਸ਼ਾਂਤ ਹੁੰਦਾ ਹੈ ਪੰਜਾਬ ਦੇ ਵਿੱਚ ਅਸੀਂ ਘੁੰਮਣ ਲਈ ਹੋਰ ਵੀ ਕਈ ਥਾਵਾਂ 'ਤੇ ਜਾਂਦੇ ਹਾਂ ਜਿੱਥੇ ਮਾਹੌਲ ਸ਼ਾਂਤ ਹੁੰਦਾ ਹੈ ਅਸੀਂ ਵੀ ਅਸੀਂ ਪੰਜਾਬ ਤੋਂ ਵੀ ਬਾਹਰ ਘੁੰਮਣ ਜਾਂਦੇ ਹਾਂ ਉਥੋਂ ਦਾ ਮੌਜੂਦਾ ਦਾਨਾ ਨਾਲ ਜੁੜੇ ਰਹਿਣ ਲਈ ਅਸੀਂ ਪੰਜਾਬ ਤੋਂ ਵੀ ਬਾਹਰ ਜਾਂਦੇ ਹਾਂ ਵੱਖ ਵੱਖ ਅਜਾਇਬ ਘਰਾਂ ਪ੍ਰਦਸ਼ਨੀਆਂ ਦੇ ਵੇਖਣ ਦਾ ਸਾਨੂੰ ਮੌਕਾ ਮਿਲਦਾ ਹੈ ਤਾਂ ਜੋ ਕਿ ਅਸੀਂ ਗੈਲਰੀਆਂ ਵਿੱਚ ਹਾਜ਼ਰ ਹੋ ਸਕੀਏ ਹੋਰ ਵੀ ਅਜਿਹੀਆਂ ਦੇਖਣ ਯੋਗ ਸ ਦੇਖਣ ਯੋਗ ਅ ਹੁੰਦੇ ਹਨ ਜੋ ਸਾਡੇ ਸਾਡੇ ਲਈ ਵਧੀਆ ਹੋ ਮੌਜੂਦਾ ਰੁਝਾਨਾਂ ਮੌਜੂਦਾ ਰੁਝਾਨਾਂ ਵਿੱਚ ਵਧੀਆ ਹੁੰਦੇ ਹਨ ਤਾਂ ਜੋ ਕਿ ਸਾਨੂੰ ਉਹਨਾਂ ਨੂੰ ਵੇਖਣ ਦਾ ਮੌਕਾ ਮਿਲੇ ਪੰਜਾਬ ਵਿੱਚ ਅਜਿਹੀਆਂ ਕਈਆਂ ਅੱਜ ਦੇ ਰੁਝਾਨਾਂ ਰੁਝਾਨਾਂ ਦੇ ਦੇਖਣ ਲਈ ਕਈ ਜ ਜਗ੍ਹਾ ਹਨ ਜੋ ਸਾਡੇ ਲਈ ਵੇਖਣਯੋਗ ਹਨ ਪੰਜਾਬ ਵਿੱਚ ਪੰਜਾਬ ਤੋਂ ਬਾਹਰ ਵੀ ਅਜਿਹੀਆਂ ਜਗ੍ਹਾ ਹਨ ਜਿਹੜੀਆਂ ਕਿ ਵੇਖ ਵੇਖਣਯੋਗ ਹਨ ਜਿਸ ਨਾਲ ਸਾਨੂੰ ਵੇਖ ਕੇ ਦੇਖ ਕੇ ਉਥੋਂ ਦੇ ਉਥੋਂ ਦਾ ਵੇਖ ਕੇ ਉਥੋਂ ਦਾ ਮਾਹੌਲ ਵੀ ਵੇਖ ਕੇ ਵਧੀਆ ਸ਼ਾਂਤ ਅਤੇ ਵਧੀਆ ਹੁੰਦਾ ਹੈ ਤਾਂ ਜੋ ਕਿ ਕਿਸੇ ਨਾਲ ਪਿਆਰ ਪ੍ਰੇਮ ਦਾ ਹੋ ਸਕੇ ਅੱਜ ਦੇ ਮ ਰੁਝਾਨਾਂ ਵਿੱਚ ਜੁੜੇ ਰਹਿਣ ਲਈ ਸਾਨੂੰ ਵੱਖ ਵੱਖ ਵੱਖ ਵੱਖ ਥਾਵਾਂ 'ਤੇ ਜਾਣਾ ਜ਼ਰੂਰੀ ਹੈ ਧੰਨਵਾਦ ਜੀ